ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵਧੀਆ ਵਧੀਆ ਤੁਸਾਂ ਦੱਸੋ ਦੇਖੋ ਭਾਅ ਜੀ ਤਰਨਤਾਰਨ ਦੇ ਵਿੱਚ ਅੱਜ ਕੱਲ੍ਹ ਤਾਂ ਨਸ਼ੇ ਇੱਕ ਤਾਂ ਜਿਹੜੇ ਹੈਗੇ ਹੈ ਨਾ ਉਹ ਇੰਨੇ ਜ਼ਿਆਦਾ ਵਧੇ ਹੋਏ ਬੱਚੇ ਨਸ਼ੇ ਕਰਨ ਲੱਗ ਪਏ ਹੈ ਨਿੱਕੇ ਨਿੱਕੇ ਬੱਚੇ ਅੱਜ ਕੱਲ੍ਹ ਨਸ਼ੇ ਫੜੇ ਹੋਏ ਉਹਨਾਂ ਨੇ ਪਹਿਲੀ ਗੱਲ ਤਾਂ ਆ ਨ ਬਾਹਰ ਭੇਜਣ ਦੀ ਫਿਰ ਦੂਜੀ ਗੱਲ ਆਹ ਆ ਗਈ ਕਿ ਇੱਥੇ ਨੌਕਰੀਆਂ ਹੀ ਨਹੀਂ ਹੈਗੀਆਂ ਬੱਚਿਆਂ ਨੂੰ ਆਪਾਂ ਇੱਥੇ ਪੜ੍ਹਾ ਕੇ ਕਰਾਂਗੇ ਵੀ ਕੀ ਕੀ ਕਰਨਗੇ ਲੋਕ ਜਦੋਂ ਤੁਸੀਂ ਇੰਨਾ ਪੜ੍ਹਾਉਂਦੇ ਹੋ ਲਿਖਾਉਂਦੇ ਹੋ ਇੰਨੇ ਪੈਸੇ ਖਰਚਦੇ ਹੋ ਉਸ ਤੋਂ ਬਾਅਦ ਵੀ ਜਦੋਂ ਨੌਕਰੀ ਨਹੀਂ ਮਿਲਦੀ ਤਾਂ ਕਿੰਨੀ ਦਰਦ ਹੁੰਦਾ ਸਿੱਧੀ ਜਿਹੀ ਗੱਲ ਆ ਜਿਹੜੀ ਭਾਅ ਜੀ ਹੈ ਨਾ ਫਿਰ ਉਸ ਤੋਂ ਬਾਅਦ ਲੋਕ ਸੋਚਦੇ ਆ ਕਿ ਆਪਾਂ ਇੰਨਾ ਪੜ੍ਹਾਉਂਦੇ ਹਾਂ ਲਿਖਾਉਂਦੇ ਹਾਂ ਬੱਚੇ ਵੀ ਇੰਨੀ ਮਿਹਨਤ ਕਰਦੇ ਆ ਇੰਨਾ ਜ਼ੋਰ ਲਾ ਕੇ ਪੜ੍ਹਦੇ ਆ ਤਾਂ ਵੀ ਉਹਨਾਂ ਦੇ ਇੱਕ ਤਾਂ ਪਹਿਲਾਂ ਨੰਬਰ ਨਹੀਂ ਆਉਂਦੇ ਠੀਕ ਆ ਕਿਉਂਕਿ ਇੱਥੇ ਪੜ੍ਹਾਈ ਦਾ ਸਿਸਟਮ ਨਹੀਂ ਠੀਕ ਹੈਗਾ ਸਿੱਧੀ ਜਿਹੀ ਜਿਹੜੀ ਗੱਲ ਆ ਠੀਕ ਆ ਜੇ ਬੱਚਾ ਮਿਹਨਤੀ ਵੀ ਹੈਗਾ ਵਾ ਕਰਦਾ ਵੀ ਪਿਆ ਵਾ ਔਖਾ ਸੌਖਾ ਹੋ ਕੇ ਉਸ ਤੋਂ ਬਾਅਦ ਉਹਨੂੰ ਨੌਕਰੀ ਨਹੀਂ ਆਉਂਦੀ ਅਤੇ ਲੋਕ ਕੀ ਕਰਦੇ ਆ ਵੀਜ਼ਾ ਅਪਲਾਈ ਕਰਦੇ ਆ ਅਤੇ ਬਾਹਰ ਭੇਜ ਦਿੰਦੇ ਆਪਣੇ ਬੱਚਿਆਂ ਨੂੰ ਉੱਥੇ ਜਾ ਕੇ ਬੱਚੇ ਇੰਨੇ ਇੰਨੇ ਪੈਸੇ ਕਮਾਉਂਦੇ ਆ ਲੱਖਾਂ ਰੁਪਿਆ ਕਮਾਉਂਦੇ ਆ ਕਿਉਂਕਿ ਉਹਨਾਂ ਨੂੰ ਲੋੜ ਹੁੰਦੀ ਆ ਕੰਮ ਕਾਰ ਕਰਨ ਵਾਲੇ ਲੋਕਾਂ ਦੀ ਅਤੇ ਜਿੱਥੇ ਤੁਹਾਨੂੰ ਇੱਥੇ ਪੰਜ ਹਜ਼ਾਰ ਰੁਪਿਆ ਮਿਲਦਾ ਜੇ ਕਿਸੇ ਬੰਦੇ ਨੂੰ ਉੱਥੇ ਡੇਢ ਲੱਖ ਮਿਲਦਾ ਹੋਵੇ ਤਾਂ ਕੋਈ ਕਿਉਂ ਨਾ ਜਾਊਗਾ ਹੁਣ ਸਾਡੇ ਇੱਥੇ ਬੱਚੇ ਗਏ ਹੀ ਕਈ ਇੱਥੇ ਪੰਜ ਪੰਜ ਹਜ਼ਾਰ ਦੀਆਂ ਨੌਕਰੀਆਂ ਕਰਨ ਦੇ ਸੀ ਬਾਹਰ ਜਾ ਕੇ ਡੇਢ ਡੇਢ ਲੱਖ ਕਮਾਉਣ ਲੱਗ ਪਏ ਉਹ ਬੰਦੇ ਅਤੇ ਫਿਰ ਵ ਉਹ ਗਏ ਵੀ ਆ ਕੈਨੇਡਾ ਭੇਜੇ ਸੀ ਅਤੇ ਪੰਜ ਸਾਲ ਉਹਨਾਂ ਨੇ ਕੈਨੇਡਾ ਕੱਟੇ ਅਤੇ ਉਸ ਤੋਂ ਬਾਅਦ ਫਿਰ ਉਹ ਅਮਰੀਕਾ ਚਲੇ ਗਏ ਅਤੇ ਹੁਣ ਉੱਥੇ ਪੱਕੇ ਹੋ ਗਏ ਹੁਣ ਤਾਂ ਅਤੇ ਫਿਰ ਕਿਉਂ ਨਾ ਕੋਈ ਭੇਜੇ ਇਸੇ ਕਰਕੇ ਤਾਂ

ਸਹੀ ਆ ਸਹੀ ਆ ਹੂੰ ਹੂੰ ਠੀਕ ਆ ਧੰਨਵਾਦ